ਛੱਬੀ ਫਰਵਰੀ ਦੋ ਹਜ਼ਾਰ ਇੱਕੀ ਤੇਈ ਦਸੰਬਰ ਦੋ ਹਜ਼ਾਰ ਬਾਈ ਉੱਨੀ ਦਸੰਬਰ ਦੋ ਹਜ਼ਾਰ ਵੀਹ ਉਨੱਤੀ ਅਪ੍ਰੈਲ ਦੋ ਹਜ਼ਾਰ ਤੇਈ ਤੇਈ ਜੂਨ ਦੋ ਹਜ਼ਾਰ ਬਾਈ